ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸੱਭਿਆਚਾਰ ਦੇ ਪਛਾਣ ਨੂੰ ਬਹੁਤ ਵੱਡਾ ਆਕਾਰ ਦਿੱਤਾ ਜਿਨ੍ਹਾਂ ਨੇ ਹਰੇਕ ਸਮੇਂ 'ਤੇ ਸਮੇਂ ਆਪਣਾ ਜੋ ਸੌਖੇ ਤਰੀਕੇ ਦੇ ਨਾਲ ਜਿੱਦਾਂ ਸਲਿਊਸ਼ਨ ਨਿਕਲਦਾ ਉਨ੍ਹਾਂ ਨੇ ਉਦਾਂ ਕੀਤਾ ਜਿੱਥੇ ਕਿਤੇ ਲੜਾਈ ਦੀ ਲੋੜ ਲੱਗੀ ਉੱਥੇ ਲੜਾਈ ਵੀ ਕੀਤੀ ਜਿੱਥੇ ਕਿਤੇ ਮਾਣ ਸਤਿਕਾਰ ਪਿਆਰ ਦੇ ਨਾਲ ਮਸਲਾ ਸੁਲਝਿਆ ਉੱਥੇ ਮਾਣ ਸਤਿਕਾਰ ਵੀ ਵਰਤਿਆ ਅਤੇ ਉਹਨਾਂ ਨੇ ਆਪਣਾ ਪਰਿਵਾਰ ਸਾਰਾ ਹੀ ਕੌਮ ਦੇ ਲੇਖੇ ਲਾ ਦਿੱਤਾ ਜਿਵੇਂ ਸਾਹਿਬਜ਼ਾਦੇ ਨੇ ਮ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਚਾਰ ਪੁੱਤਰ ਉਹ ਸ਼ਹੀਦ ਹੋਏ ਮਾਤਾ ਜੀ ਸ਼ਹੀਦ ਹੋਏ ਉਨ੍ਹਾਂ ਦੇ ਪਿਤਾ ਜੀ ਵੀ ਸ਼ਹੀਦ ਹੋਏ ਅਤੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਪਰਿਵਾਰ ਹੈ ਜੋ ਸਾਰਾ ਹੀ ਸਿੱਖ ਕੌਮ ਦੇ ਉਤੋਂ ਦੀ ਵਾਰ ਦਿੱਤਾ ਜੋ ਕਿ ਬਹੁਤ ਸਿੱਖ ਕੌਮ ਦੇ ਲਈ ਵੀ ਇੱਕ ਮਾਣ ਵਾਲੀ ਵੱਡੀ ਗੱਲ ਹੈ ਜੋ ਕਿ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਲਈ ਕਰ ਗਏ ਨੇ ਉਹ ਬਹੁਤ ਜ਼ਿਆਦਾ ਇੱਕ ਮਾਣ ਵਾਲੀ ਗੱਲ ਹੈ